ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਹਾਂਜੀ ਹਾਂਜੀ ਭੁਪਿੰਦਰ ਸਿੰਘ ਬੋਲਦਾ ਸਰ ਭੁਪਿੰਦਰ ਸਿੰਘ ਹੀ ਬੋਲਦਾ ਸਰ ਵਧੀਆ ਵਧੀਆ ਸਰ ਤੁਸੀਂ ਦੱਸੋ ਹਾਂਜੀ ਹਾਂਜੀ ਸਰ ਮਹਿੰਦਰਾ ਏਜੰਸੀ ਤੋਂ ਗੱਲ ਕਰਦੇ ਹਾਂ ਦੱਸੋ ਜੀ ਕੀ ਸੇਵਾ ਕਰ ਸਕਦੇ ਹਾਂ ਹਾਂਜੀ ਹਾਂਜੀ ਸਰ ਕਿਹੜੀ ਲੈਣੀ ਆ ਸਰ ਤੁਸੀਂ ਦੱਸੋ ਆਪਣੇ ਕੋਲ ਸਕੋਰਪੀਓ ਖੜ੍ਹੀ ਹੈ ਥਾਰ ਵੀ ਖੜ੍ਹੀ ਹੈ ਸਰ ਨਿਊ ਮਾਡਲ 'ਚ ਖੜ੍ਹੀਆਂ ਨੇ ਸਾਰੀਆਂ ਹੀ ਗੱਡੀਆਂ ਜੀ ਹਾਂਜੀ ਥਾਰ ਸਰ ਬਲੈਕ 'ਚ ਜ਼ਿਆਦਾ ਵਿਕ ਰਹੀ ਹੈ ਵੈਸੇ ਤਾਂ ਅੱਜ ਕੱਲ੍ਹ ਬਲੈਕ ਵੀ ਆਪਣੇ ਕੋਲ ਖੜ੍ਹੀ ਹੈ ਬਲੈਕ ਹੀ ਜ਼ਿਆਦਾ ਖੜ੍ਹੀਆਂ ਨੇ ਵੈਸੇ ਜੇ ਬਾਕੀ ਤੁਹਾਨੂੰ ਹੋਰ ਵੀ ਕਲਰ ਚਾਹੀਦਾ ਉਹ ਅਰੇਂਜ ਕਰਾ ਦੇਵਾਂਗੇ ਆਪਾਂ

ਅਰੇਂਜ ਸਰ ਜੇ ਤਾਂ ਬਲੈਕ ਤੋਂ ਇਲਾਵਾ ਹੋਰ ਵੀ ਕਲਰ ਲੈਣਾ ਉਹਨੂੰ ਥੋੜ੍ਹਾ ਟਾਈਮ ਲੱਗੂਗਾ ਜੇ ਤੁਹਾਨੂੰ ਮਤਲਬ ਬਲੈਕ ਹੀ ਚਾਹੀਦੀ ਉਹ ਜਲਦੀ ਤੋਂ ਜਲਦੀ ਅਰੇਂਜ ਹੋਜੂਗੀ ਹਾਂਜੀ ਸਰ ਹਾਂਜੀ ਚੱਲਦੇ ਨੇ ਔਫਰ ਫੈਸਟੀਵਲ ਕਰਕੇ ਔਫਰ ਹੈਗੇ ਨੇ ਸਰ ਸਟਾਰਟਿੰਗ ਸਰ ਤੁਹਾਨੂੰ ਵੀਹ 'ਚ ਪਉਗੀ ਜੀ ਵੀਹ ਕੁ ਲੱਖ ਸਟਾਰਟਿੰਗ ਹੈ ਹਾਂਜੀ ਹਾਂਜੀ ਸਰ ਕਾਗਜ਼ਾਂ ਹਾਂਜੀ ਬਾਕੀ ਜੇ ਤੁਸੀਂ ਕੁਛ ਐਡ ਕਰਵਾਉਣਾ ਵਿੱਚ ਉਹ ਥੋੜ੍ਹੀ ਜਿਹੀ ਪੇਮੈਂਟ ਵ ਵਧੀ ਜਾਉਗੀ

ਹਾਂਜੀ ਹਾਂਜੀ ਸਰ ਬਲੈਕ ਹੀ ਜ਼ਿਆਦਾ ਵਿਕ ਰਿਹਾ ਬਾਕੀ ਤੁਸੀਂ ਦੇਖ ਲਓ ਤੁਹਾਨੂੰ ਕਿਹੜਾ ਕਲਰ ਚਾਹੀਦਾ ਹਾਂਜੀ ਸਰ ਕੋਈ ਨਹੀਂ ਸਰ ਬਲੈਕੀ ਦਾ ਹਾਂਜੀ ਹਾਂਜੀ ਹਾਂਜੀ

ਫਤਿਹਗੜ੍ਹ ਸਾਹਿਬ ਜਦੋਂ ਜੀ ਤੁਸੀਂ ਬ ਆਪਣੇ ਬ ਮੋੜਾਂ 'ਤੇ ਆ ਜਾਉਂਗੇ ਮੋੜਾਂ 'ਤੇ ਮੋੜਾਂ ਤੋਂ ਅੱਗੇ ਸਰ ਜਿਹੜਾ ਆਪਣਾ ਅਜੈ ਰਿਲਾਇੰਸ ਵਾਲਿਆਂ ਦਾ ਮੇਨ ਬ ਹੈ ਸਟੋਰ ਹੈ ਹਾਂ ਉਹਦੇ ਨੀਅਰ ਅਬਾਊਟ ਹੈ ਜੀ ਹਾਂਜੀ ਹਾਂਜੀ ਬਸ ਸੇਵ ਕਰ ਲਿਓ ਸਰ ਮ ਕੋਲ ਕਰਕੇ ਜਦੋਂ ਮਰਜ਼ੀ ਆ ਜਾਇਓ ਕਿੱ ਹਾਂਜੀ ਕਿੱਦਣ ਆਉਣਾ ਤੁਸੀਂ ਦੱਸ ਦਿਓ ਸਰ ਤੁਸੀਂ ਕੱਲ੍ਹ ਆ ਜਾਇਓ ਸਰ ਦਸ ਵਜੇ ਤੋਂ ਬਾਅਦ ਜਦੋਂ ਮਰਜ਼ੀ ਆਜਿਓ ਕੱਲ੍ਹ ਹਾਂਜੀ

ਠੀਕ ਹੈ ਸਰ ਠੀਕ ਹੈ ਆ ਜਾਇਓ ਕੋਈ ਨਹੀਂ ਥੈਂਕ ਯੂ ਸਰ ਮੋਸਟ ਵੈਲਕਮ ਜੀ ਓਕੇ ਸਰ